ਸਾਡੇ ਪਿੰਡ ਵਿੱਚ ਜਦੋਂ ਕਿਸੇ ਮ੍ਰਿਤਕ ਪ੍ਰਾਣੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਹੁੰਦੇ ਹਨ ਉਹਨਾਂ ਤੱਕ ਸੁਨੇਹਾ ਪਹੁੰਚਦਾ ਕੀਤਾ ਜਾਂਦਾ ਹੈ ਵੀ ਇੱਕ ਟਾਈਮ ਦਿੱਤਾ ਜਾਂਦਾ ਹੈ ਵੀ ਐਨੇ ਸਮੇਂ ਦੇ ਸੰਸਕਾਰ ਕੀਤਾ ਜਾਵੇਗਾ ਜਦੋਂ ਸਾਰੇ ਇਕੱਤ ਇਕੱਠੇ ਹੋ ਜਾਂਦੇ ਹਨ ਸਾਰਾ ਸਾਰਾ ਭਾਈਚਾਰਾ ਇਕੱਤਰ ਹੋ ਜਾਂਦਾ ਹੈ ਫਿਰ ਉਸ ਮ੍ਰਿਤਕ ਪ੍ਰਾਣੀ ਨੂੰ ਪਾਣੀ ਦੇ ਨਾਲ ਨਵਾਇਆ ਜਾਂਦਾ ਹੈ ਦਹੀਂ ਅਤੇ ਹੋਰ ਸਮੱਗਰੀ ਪਾ ਕੇ ਉਸਨੂੰ ਨਵਾਇਆ ਜਾਂਦਾ ਹੈ ਨਵਾ ਕੇ ਫਿਰ ਉਸਦੇ ਨਵੇਂ ਸਵਾਏ ਗਏ ਬਸਤਰ ਜੋ ਕੱਪੜੇ ਹੁੰਦੇ ਹਨ ਉਹ ਪਾਏ ਜਾਂਦੇ ਹਨ ਉਸ ਤੋਂ ਇਲਾਵਾ ਉਸਦੇ ਸਿਰ 'ਤੇ ਪੱਗ ਬੰਨ੍ਹੀ ਜਾਂਦੀ ਹੈ ਚਾਰ ਬੰਦੇ ਫਿਰ ਉਸ ਅ ਨੂੰ ਅਰਥੀ 'ਤੇ ਲੱ ਪੌੜੀ ਜਿਸਨੂੰ ਬੋਲਦੇ ਹਨ ਉਸ 'ਤੇ ਚੱਕ ਕੇ ਪਿੱਛੇ ਸਾਰਾ ਭਾਈਚਾਰਾ ਸਾਕ ਸੰਬੰਧੀ ਤੁ ਤੁਰਦੇ ਹਨ ਫਿਰ ਉਸਨੂੰ ਸੰਸਕਾਰ ਵਾਲੀ ਜਗ੍ਹਾ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਤੇਲ ਪਾਣੀ ਲੱਕੜਾਂ ਅਤੇ ਹੋਰ ਪਾਥੀਆਂ ਪਾ ਕੇ ਉਸਨੂੰ ਅਗਨ ਭੇਂਟ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਅਰਦਾਸ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ